ਇੱਕ ਵਾਰ ਅਸੀਂ ਸੁਖਮਨੀ ਸਾਹਿਬ ਦਾ ਘਰ ਵਿੱਚ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਸੀ ਤੇ ਸਾਡੀ ਇੰਨੀ ਸਲਾਹ ਨਹੀਂ ਸੀ ਕਿ ਅਸੀਂ ਬਹੁਤ ਜ਼ਿਆਦਾ ਆਂਢ ਗੁਆਂਢ ਨੂੰ ਬੁਲਾਵਾਂਗੇ ਪਰ ਤੁਰੰਤ ਸਲਾਹ ਬਣ ਗਈ ਕਿ ਮਤਲਬ ਸਾਰਿਆਂ ਨੂੰ ਹੀ ਸੁਨੇਹਾ ਦੇ ਦੇਈਏ ਅਤੇ ਇਹ ਸੁਨੇਹਾ ਨ ਸਾਰੇ ਲੋਕਾਂ ਨੂੰ ਦਿੱਤਾ ਤਾਂ ਯਾਨੀ ਕਿ ਸਾਰੇ ਲੋਕ ਆ ਗਏ ਅਤੇ ਬਹੁਤ ਜ਼ਿਆਦਾ ਇਕੱਠ ਹੋ ਗਿਆ ਇਕੱਠ ਹੋਣ ਦੇ ਕਾਰਨ ਮਤਲਬ ਕਿ ਉੱਧਰੋ ਭੋਗ ਪੈਣ ਦੀ ਤਿਆਰੀ ਸੀ ਉੱਦਾਂ ਦਾ ਤਿਆਰੀ ਸੀ ਉੱਧਰ ਸਾਡਾ ਮਤਲਬ ਦਾਲ ਸਬਜ਼ੀ ਰੋਟੀ ਵਗੈਰਾ ਨਹੀਂ ਪੱਕਿਆ ਸੀ ਤਿਆਰ ਨਹੀਂ ਸੀ ਤਾਂ ਇਸ ਕਰਕੇ ਜਲਦੀ ਤੋਂ ਜਲਦੀ ਬਣਾਉਣ ਲਈ ਅੱਧੀ ਤਿਆਰੀ ਸਾਡੀ ਉੱਧਰ ਹੋ ਚੁੱਕੀ ਸੀ ਪਹਿਲਾਂ ਤਾਂ ਜ਼ਿਆਦਾ ਇਕੱਠ ਹੋਣ ਦੇ ਕਾਰਨ ਕਾਰਨ ਹੋਰ ਵੀ ਦਾਲ ਸਬਜ਼ੀ ਅਤੇ ਰੋਟੀ ਅ ਜ਼ਰੂਰੀ ਸੀ ਇਸ ਕਰਕੇ ਅਸੀਂ ਤਾਂ ਮੈਂ ਆਪਣਾ ਤਜਰਬਾ ਕੀਤਾ ਕਿ ਮੈਂ ਦੋ ਗੈਸਾਂ ਦੇ ਕੁੱਕਰਾਂ ਵਿੱਚ ਦਾਲਾਂ ਸਬਜ਼ੀਆਂ ਦੀ ਸੀਟੀਆਂ ਮਰਵਾਈਆਂ ਅਤੇ ਇੱਕ ਪਾਸੇ ਤੜਕਾ ਤਿਆਰ ਕਰਕੇ ਉਹਨਾਂ ਨੂੰ ਤੜਕਾ ਲਾਇਆ ਅਤੇ ਫਿਰ ਉਸ ਇੱਕ ਤਵੀਂ 'ਤੇ ਚੇ ਹੋਰ ਹੋਰੀਆਂ ਨੂੰ ਹੋਰ ਹੋਰ ਗੈਸਟ ਮਤਲਬ ਕਿ ਉਹਨਾਂ ਨੂੰ ਕਿਹਾ ਵੀ ਰੋਟੀ ਅ ਰੋਟੀਆਂ ਪਕਵਾਓ ਪਕਾਓ ਜਲਦੀ ਜਲਦੀ ਤਾਂ ਅਸੀਂ ਤਿਆਰੀ ਕੀਤੀ ਤਾਂ ਉਹ ਕੁੱਕਰਾਂ 'ਚ ਮਤਲਬ ਕਿ ਆਪਣਾ ਉਹ ਇਸ ਤਰ੍ਹਾਂ ਮੈਂ ਆਪਣੇ ਰੀਲੇਟਿਵਾਂ ਤੋਂ ਦਾਲ ਸਬਜ਼ੀ ਕੀਤਾ ਤਾਂ ਟਾਇਮ ਸਿਰ ਭੋਗ ਤੋਂ ਪਹਿਲਾਂ ਸਾਰੀ ਤਿਆਰੀ ਹੋ ਚੁੱਕੀ ਸੀ ਤਾਂ ਉਹ ਦਾ ਦਾਲਾਂ ਅਤੇ ਸਬਜ਼ੀਆਂ ਸਾਰਾ ਮਤਲਬ ਵਧੀਆ ਗੁਰੂ ਕਾ ਲੰਗਰ ਚੱਲਿਆ ਇਸ ਕਾ ਨਾਲ ਹੀ ਸਾਡੇ ਮਤਲਬ ਕਿ ਵਧੀਆ ਹੋਇਆ ਤਾਂ ਸਾਰਿਆਂ ਨੇ ਮੇਰੀ ਪ੍ਰਸ਼ੰਸਾ ਕੀਤੀ